ਅਧਿਆਪਕਾਂ ਦੀ ਘਾਟ ਦੇ ਮੁੱਦੇ ਦੇ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਵੱਲੋਂ ਉਹ ਜਿਹੜੀਆਂ ਉਹ ਸਮੇਂ ਸਮੇਂ ਸਿਰ 'ਤੇ ਆ ਜਿਹੜੀਆਂ ਉਹ ਭਰਤੀਆਂ ਖੋਲ੍ਹੀਆਂ ਗਈਆਂ ਅਤੇ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਉਹ ਅਧਿਆਪਕ ਇਹਦੇ ਵਿੱਚ ਭਰਤੀ ਕੀਤੇ ਗਏ ਹੈ ਅਤੇ ਹਾਲ ਹੀ ਦੇ ਵਿੱਚ ਵੇਖਿਆ ਜਾਂਦਾ ਕੁਝ ਕੁ ਭਰਤੀਆਂ ਦੇ ਵਿੱਚ ਜਿਹੜੇ ਉਹਨਾਂ ਨੂੰ ਸਟੇਸ਼ਨ ਵੀ ਅਲੋਟ ਹੋਏ ਆ ਉਹ ਵੀ ਨੇੜੇ ਦੇ ਸਟੇਸ਼ਨ ਹੈ ਜਿਹੜੇ ਅਲੋਟ ਹੋਏ ਆ ਤਾਂ ਕਿ ਅਧਿਆਪਕਾਂ ਨੂੰ ਕਿਤੇ ਰਹਿਣ ਦੇ ਵਿੱਚ ਜਾਂ ਜ਼ਿਆਦਾ ਛੁੱਟੀਆਂ ਲੈਣ ਦੇ ਵਿੱਚ ਕੋਈ ਜਿਹੜੀ ਉਹ ਦਿੱਕਤ ਨਾ ਆਵੇ ਅਤੇ ਅਧਿਆਪਕਾਂ ਦੀ ਗੁਣਵੱਤਾ ਦੇ ਵਿੱਚ ਸੁਧਾਰ ਕਰਨ ਲਈ ਵੀ ਸਰਕਾਰ ਵੱਲੋਂ ਆ ਜਿਹੜੇ ਉਹ ਉਹਨਾਂ ਦੇ ਟ੍ਰੇਨਿੰਗ ਕੈਂਪ ਸਮੇਂ ਸਮੇਂ ਸਿਰ ਦੇ ਉੱਤੇ ਜਿਹੜੇ ਲਾਏ ਜਾਂਦੇ ਹੈ ਅਤੇ ਉਹਨਾਂ ਨੂੰ ਕੁਝ ਕੁ ਇਸ ਤਰ੍ਹਾਂ ਗਾਈਡ ਲਾਈਨਸ ਜਿਹੜੀਆਂ ਬੁੱਕਸ ਆ ਉਹ ਵੀ ਪ੍ਰੋਵਾਈਡ ਕਰਵਾਈਆਂ ਜਾਂਦੀਆਂ ਨੇ ਅਤੇ ਸਮੇਂ ਸਮੇਂ ਸਿਰ ਦੇ ਉੱਤੇ ਹਾਇਰ ਐਜੂਕੇਸ਼ਨ ਵੱਲੋਂ ਪੰਜਾਬ ਸਰਕਾਰ ਵੱਲੋਂ ਕੀਤੇ ਭਰਤੀਆਂ ਜਿਹੜੇ ਪੰਜਾਬ ਸਰਕਾਰ ਵੱਲੋਂ ਭਰਤੀ ਕੀਤੇ ਗਏ ਟੀਚਰਾਂ ਦੀ ਬਕਾਇਦਾ ਇੰਟਰਵਿਊ ਵੀ ਰਹਿੰਦੀ ਹੈ ਅਤੇ ਨਵੀਆਂ ਜਿਹੜੀਆਂ ਪੁਸਤਕਾਂ ਸਿਲੇਬਸਾਂ ਦੇ ਵਿੱਚ ਲਾਗੂ ਹੁੰਦੀਆਂ ਨੇ ਉਹਨਾਂ ਦੇ ਸਿਲੇਬਸ ਸਬੰਧੀ ਵੀ ਪੰਜਾਬ ਸਰਕਾਰ ਵੱਲੋਂ ਆ ਜਿਹੜੇ ਬਹੁਤ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਹੈ ਅਧਿਆਪਕਾਂ ਦੀ ਗੁਣਵੱਤਾ ਦੇ ਵਿੱਚ ਇਹ ਆ ਵੀ ਪੰਜਾਬ ਸਰਕਾਰ ਵੱਲੋਂ ਸਕੂਲਾਂ ਦੇ ਸਮੇਂ ਦਾ ਵੀ ਖਾਸ ਕਰਕੇ ਧਿਆਨ ਰੱਖਿਆ ਜਾਂਦਾ ਤਾਂ ਕਿ ਅਧਿਆਪਕ ਆ ਜਿਹੜੇ ਉਹ ਸਮੇਂ ਸਿਰ ਸਕੂਲ ਪਹੁੰਚਣ ਹੈ ਨਾ ਹਾਜ਼ਰੀ ਐ ਜਿਹੜੀ ਉਹ ਬਾਓਮੈਟਰਿਕ ਕਰੀ ਜਾਂਦੀ ਹੈ ਇਹਦੇ ਨਾਲ ਵੀ ਕੀ ਹੁੰਦਾ ਕਿ ਅਧਿਆਪਕ ਜਿਹੜਾ ਆਪਾਂ ਸਮੇਂ ਦਾ ਪੰਕਚੁਅਲ ਹੁੰਦਾ ਅਤੇ ਇਸ ਤੋਂ ਬਿਨਾਂ ਵੀ ਪੰਜਾਬ ਸਰਕਾਰ ਵੱਲੋਂ ਸਮੇਂ ਸਮੇਂ ਸਿਰ ਦੇ ਉੱਤੇ ਬਹੁਤ ਸਾਰੇ ਹੈ ਜਿਹੜੇ ਉਹ ਉਪਾਅ ਉਹ ਕੀਤੇ ਜਾਂਦੇ ਨੇ ਧੰਨਵਾਦ